ਦੋ ਅਕਤੂਬਰ ਦੋ ਹਜ਼ਾਰ ਇੱਕ ਚਾਰ ਮਈ ਦੋ ਹਜ਼ਾਰ ਪੰਜ ਸਤਾਰਾਂ ਫਰਵਰੀ ਉੱਨੀ ਸੌ ਅਠਾਨਵੇਂ ਤੇਈ ਜੁਲਾਈ ਦੋ ਹਜ਼ਾਰ ਸੱਤ ਛੱਬੀ ਮਾਰਚ ਦੋ ਹਜ਼ਾਰ ਇੱਕੀ